ਬਿਲਕੁਲ ਜੀ ਮੈਂ ਇਸ ਟੈਕਨੋਲਜੀ ਫੋਮ ਦੇ ਬਾਰੇ ਔਨਲਾਈਨ ਫੋਮ ਦੇ ਬਾਰੇ ਬਿਲਕੁਲ ਡਿਸਕਸ ਕਰਨਾ ਚਾਹਵਾਂ ਗੇ ਕਿਉਂਕਿ ਅੱਜ ਦੀ ਡੇਟ 'ਚ ਸਾਰਾ ਕੁਛ ਔਨਲਾਈਨ ਫੋਮ ਔਨਲਾਈਨ ਹੀ ਹੋ ਗਿਆ ਹੈ ਅਗਰ ਮੈਂ ਕਿਸੀ ਨੂੰ ਵੀ ਅੱਜ ਅਡਵਾਈਸ ਦਿੰਦਾ ਕਿ ਜਾ ਕੇ ਫਿਜੀਕਲੀ ਹੋਏ ਆਓ ਲੇਕਿਨ ਉਸ ਤੋਂ ਟਾਈਮ ਸੇਫਟੀ ਦੇ ਨਾਲ ਮੈਂ ਪਰੇਫਰ ਕਰਾਂਗਾ ਔਨਲਾਈਨ ਦੇ ਲਈ ਕਿਉਂਕਿ ਜਿੱਦਾਂ ਈ ਵੇਹੀਕਲ ਦੀ ਗੱਲ ਅਸੀਂ ਅਸੀਂ ਲਰਨਿੰਗ ਦੀ ਗੱਲ ਕਰ ਰਹੇ ਹਾਂ ਲਾਇਸੈਂਸ ਦੀ ਗੱਲ ਕਰ ਰਹੇ ਹਾਂ ਜਾਂ ਅਸੀਂ ਫੂਡ ਦੀ ਗੱਲ ਕਰਦੇ ਹਾਂ ਤਾਂ ਮੈਂ ਹਾਲ ਹੀ 'ਚ ਇੱਕ ਫੋਮ ਭਰਿਆ ਸੀ ਜੋ ਹੈਗਾ ਹੈ ਲਰਨਿੰਗ ਲਾਈਸੈਂਸ ਦੇ ਲਈ ਬੜਾ ਸੌਖਾ ਫੋਮ ਹੈ ਜੀ ਪਰਿਵਾਹਨ ਦੇ ਸਾਈਡ ਜਾ ਕੇ ਮੈਂ ਡਿਟੇਲ ਸਾਰੀਆਂ ਭਰੀਆਂ ਸਾਰਾ ਡੋਕੂਮੈਂਟ ਅਪਲੋਡ ਕੀਤੇ ਜੀ ਸਾਰੇ ਆਧਾਰ ਕਾਰਡ ਸਾਰਾ ਅਪਲੋਡ ਕੀਤਾ ਅਤੇ ਮੈਨੂੰ ਅਰਾਮ ਨਾਲ ਗੌਮਿੰਟ ਫੀਸ ਦੇ ਕੇ ਮੈਂ ਅਰਾਮ ਨਾਲ ਜਾ ਕੇ ਉਹਨੂੰ ਰਜਿਸਟਰ ਕਰ ਲਿਆ ਹਾਲ ਹੀ 'ਚ ਇੱਕ ਫੋਮ ਹੋਰ ਭਰਿਆ ਸੀਗਾ ਜਿਹੜਾ ਰਜਿਸਟਰੇਸ਼ਨ ਸੀਗਾ ਆਪਣਾ ਫੂਡ ਸੇਫਟੀ ਦਾ ਐਂਡ ਸਟੈਂਡਰਡ ਅਥੋਰਟੀ ਓਫ ਇੰਡੀਆ ਜਿਹਨੂੰ ਅਸੀਂ ਫੋਸਕੋਜ਼ ਵੀ ਕਹਿੰਦੇ ਹਾਂ ਫੂਡ ਸੇਫਟੀ ਕੰਪਲਾਈਂਸਸ ਸਿਸਟਮ ਬਹੁਤ ਸੌਖਾ ਹੈ ਜੀ ਉਹਦੇ ਲਈ ਪਹਿਲਾਂ ਤੁਸੀਂ ਪਹਿਲਾਂ ਉਹ ਭਰ ਲਓ ਪੂਰਾ ਆਪਣੇ ਅਪਲੋਡ ਕਰ ਦਿਓ ਡੋਕੂਮੈਂਟ ਅਤੇ ਮੈਂ ਤਾਂ ਇਹ ਹੀ ਕਹਾਂਗਾ ਸਾਰਿਆਂ ਨੂੰ ਕਿ ਜੇ ਔਨਲਾਈਨ ਫੋਮ ਦਾ ਇੰਨਾਂ ਬੈਨੀਫਿਟ ਹੈ ਜੀ ਤੁਸੀਂ ਘਰ ਬੈਠੇ ਬੈਠੇ ਆਪ ਸਾਰਾ ਫੋਮ ਭਰ ਸਕਦੇ ਹੋ ਇਹ ਸਾਰੇ ਲਈ ਵਧੀਆ ਜੀ ਅੱਜ ਦੀ ਜਨਰੇਸ਼ਨ ਸਾਰਾ ਕੁਛ ਔਨਲਾਈਨ ਚੱਲ ਰਿਹਾ ਅਤੇ ਔਨਲਾਈਨ ਫੋਮ ਤੁਹਾਡੇ ਲਈ ਵਾਕਿਆ ਹੀ ਬਹੁਤ ਜ਼ਰੂਰੀ ਹੈ ਜੀ